ਖੇਤੀਬਾੜੀ ਦੀ ਬਹੁਤ ਮਹੱਤਤਾ ਹੈ ਇਸ ਵਿੱਚ ਉਸ ਦਿਨ ਦੀ ਇਹ ਗੱਲ ਹੈ ਕਿ ਜੇਕਰ ਕਣਕਾਂ ਲਗਾਈਆਂ ਹੋਣ ਅਤੇ ਬਾਰਿਸ਼ ਹੋ ਜਾਵੇ ਤਾਂ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਖੇਤੀਬਾੜੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਇਸ ਤੋਂ ਸਾਨੂੰ ਅਨਾਜ ਮਿਲਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਦਾ ਹੈ ਮਿਲਦੀਆਂ ਹਨ ਖੇਤੀਬਾੜੀ ਵਿੱਚ ਫਲਾਂ ਦੀ ਵੀ ਅਤੇ ਸਬਜ਼ੀਆਂ ਦੀ ਵੀ ਖੇਤੀ ਕੀਤੀ ਜਾਂਦੀ ਹੈ ਜ਼ਰੂਰੀ ਨਹੀਂ ਕਿ ਕਣਕਾਂ ਅਤੇ ਚੋਲਾਂ ਦੀ ਕੀਤੀ ਜਾਵੇ ਖੇਤੀ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਖੇਤੀ ਕੀਤੀ ਜਾਂਦੀ ਹੈ ਖੇਤੀ ਲਈ ਬਹੁਤ ਸਾਰੀ ਚੀਜ਼ਾਂ ਦੀ ਲੋੜ ਪੈਂਦੀ ਹੈ ਟਰੈਕਟਰ ਦੀ ਵੀ ਇਸ ਵਿੱਚ ਬਹੁਤ ਸਾਰੀ ਮਹੱਤਤਾ ਹੈ ਟਰੈਕਟਰ ਨਾਲ ਵੀ ਵਾਹੀ ਕੀਤੀ ਜਾਂਦੀ ਹੈ ਅਤੇ ਜਦੋਂ ਕਣਕ ਅਤੇ ਝੋਨਾ ਆਂਦ ਆ ਜਾਂਦਾ ਹੈ ਤਾਂ ਉਸਨੂੰ ਮੰਡੀ ਲੈ ਜਾ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਸਰ੍ਹੋਂ ਦੀ ਵੀ ਖੇਤੀ ਕੀਤੀ ਜਾਂਦੀ ਹੈ ਸਰ੍ਹੋਂ ਦੀ ਖੇਤੀ ਵੀ ਬਹੁਤ ਚੰਗੇ ਤਰੀਕੇ ਨਾਲ ਹੁੰਦੀ ਹੈ ਅਤੇ ਇਹ ਵੀ ਸਾਡੇ ਸਾਨੂੰ ਤੇਲ ਦਿੰਦਾ ਹੈ ਸਰ੍ਹੋਂ ਵਿੱਚੋਂ ਸਾਨੂੰ ਤੇਲ ਮਿਲਦਾ ਹੈ ਸਰ੍ਹੋਂ ਵੀ ਸਾਡੇ ਲਈ ਸਿਹਤ ਲਈ ਬਹੁਤ ਚੰਗੀ ਹੈ ਇਸ ਸਰ੍ਹੋਂ ਤੇਲ ਦੀ ਲੋਕ ਮਾਲਿਸ਼ ਵੀ ਕਰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਧੰਨਵਾਦ